ਸਾਡੇ ਖੇਤਰ ਬਠਿੰਡਾ ਦੇ ਵਿੱਚ ਜਿਵੇਂ ਆਪਣੇ ਤੀਰਥ ਯਾਤਰਾਵਾਂ ਹੋ ਗਈਆਂ ਜਿਵੇਂ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਕੇ ਸਾਬੋਂ ਉੱਥੇ ਬਹੁਤ ਭਾਰੀ ਮੇਲਾ ਲੱਗਦਾ ਹੈ ਅਤੇ ਹੋਰ ਆਪਣੇ ਇੱਥੇ ਪੰਜਾਬ ਦੇ ਵਿੱਚ ਦਸਵੰਧ ਭੇਟਾਂ ਕਰੋ ਦਸਵੰਧ ਕੱਢਣੇ ਚਾਹੀਦੇ ਆ ਆਪਣੀ ਕਿਰਤ ਕਮਾਈ ਵਿੱਚੋਂ ਦਸਵਾਂ ਹਿੱਸਾ ਕਿਸੇ ਲੋੜਵੰਦ ਨੂੰ ਦੇ ਦਿਓ ਤਾਂ ਬਹੁਤ ਵਧੀਆ ਪੁੰਨ ਦਾ ਕੰਮ ਹੈ ਅਤੇ ਰਸਮਾਂ ਜਿਵੇਂ ਲੋਹੜੀ ਹੋ ਗਈ ਆਪਣੀ ਲੋਹੜੀ ਪੰਜਾਬ ਦੇ ਵਿੱਚ ਮਸ਼ਹੂਰ ਆ ਜੇ ਨਵੇਂ ਵਿਆਹੇ ਜੋੜੇ ਦੀ ਲੋਹੜੀ ਮਨਾਈ ਜਾਂਦੀ ਜਾਂ ਕਿਸੇ ਘਰ ਮੁੰਡਾ ਹੁੰਦਾ ਖੁਸ਼ੀ ਵਿੱਚ ਲੋਹੜੀ ਮਨਾਈ ਜਾਂਦੀ ਹੈ ਅਤੇ ਅਨੰਦਪੁਰ ਸਾਹਿਬ ਦੇ ਵਿੱਚ ਜਿਵੇਂ ਹੋਲੀ ਨਹੀਂ ਹੋਲਾ ਮਹੱਲਾ ਮਨਾਇਆ ਜਾਂਦਾ ਪੰਜਾਬ ਦੇ ਲੋਕਾਂ ਵੱਲੋਂ ਅਤੇ ਲੋਕ ਜਿਵੇਂ ਅਲੱਗ ਅਲੱਗ ਜਾਂਦੇ ਆ ਟਰੈਕਟਰਾਂ 'ਤੇ ਜਾਂਦੇ ਆ ਗੱਲਾਂ ਬਾਤਾਂ ਕਰਦੇ ਜਾਂਦੇ ਆ ਜਾਂ ਹੋਰ ਮੋਟਰਸਾਈਕਲਾਂ 'ਤੇ ਜਾਂਦੇ ਆ ਕਈ ਅਤੇ ਹੋਰ ਪੰਜਾਬ ਦੇ ਵਿੱਚ ਇੱਕ ਬਠਿੰਡੇ ਦੇ ਵਿੱਚ ਖਾਸ ਕਿਲਾ ਮੁਬਾਰਕ ਹੈ ਘੁੰਮਣ ਦੇ ਲਈ ਜੋ ਕਿ ਬਹੁਤ ਪੁਰਾਣਾ ਕਿਲਾ ਹੈ ਘੁੰਮਣ ਦੇ ਲਈ ਬਹੁਤ ਵਧੀਆ ਹੈ ਉਹ ਅਤੇ